ਹੈਲੋ ਹਾਂਜੀ ਰਾਮ ਰਾਮ ਜੀ ਹਾਂਜੀ ਹਾਂਜੀ ਅੱਛਾ ਅੱਜ ਕੱਲ੍ਹ ਤਾਂ ਦੇਖੋ ਸ਼ਰਾਰਾ ਸੂਟ ਚੱਲਦੇ ਪਏ ਹੈ ਸਰਕੂਲਰ ਪਲਾਜ਼ੋ ਵਿਦ ਸ਼ੋਰਟ ਕੁੜਤੀ ਚੱਲਦੇ ਪਏ ਹੈ ਔਰ ਹਾਂਜੀ ਪੈਂਟ ਪਲਾਜ਼ੋ ਨਾਲ ਅਮਰੇਲਾ ਸਲੀਵਸ ਵਾਲੇ ਸੂਟ ਬੈਨ ਕੋਲਰ ਵਾਲੇ ਸ਼ਰਟਸ ਨਾਲ ਪੰਜਾਬੀ ਸੂਟ ਵੀ ਚੱਲਦੇ ਪਏ ਹੈ ਲੌਂਗ ਸ਼ਰਟ ਸਲਵਾਰ ਸੂਟ ਜਾਗੋ ਵਾਸਤੇ ਜਿੱਦਾਂ ਹਾਂਜੀ ਹਾਂਜੀ ਹਾਂਜੀ ਦੇਖੋ ਬਰਾਤ ਵਾਲੇ ਜਿਸ ਦਿਨ ਹੁੰਦਾ ਮੇਨ ਆਪਣਾ ਡੇ ਉਸ ਦਿਨ ਤੁਸੀਂ ਡਰੈੱਸ ਸਿਲਵਾ ਸਕਦੇ ਹੋ ਕੋਈ ਵੀ ਲੌਂਗ ਡਰੈੱਸ ਜਾਂ ਜੇ ਤੁਸੀਂ ਪਾਉਂਦੇ ਓਂ ਤਾਂ ਨਹੀਂ ਤਾਂ ਤੁਸੀਂ ਸਰਕੂਲਰ ਪਲਾਜ਼ੋ ਦੇ ਨਾਲ ਆਪਣੀ ਕੁੜਤੀ ਸਿਲਵਾ ਲਓ ਜਾਗੋ ਵਾਸਤੇ ਪੰਜਾਬੀ ਸੂਟ ਹਾਂਜੀ ਜਾਗੋ ਵਾਸਤੇ ਪੰਜਾਬੀ ਸੂਟ ਚੱਲਦਾ ਹੈ ਹਾਂਜੀ ਉਸ ਤੋਂ ਬਾਅਦ ਮਹਿੰਦੀ ਵਾਸਤੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਮਹਿੰਦੀ ਗ੍ਰੀਨ ਕਲਰ ਦੇ ਸੂਟ ਪਾਏ ਜਾਂਦੇ ਹੈ ਮਹਿੰਦੀ ਮਹਿੰਦੀ ਨਹੀਂ ਨਹੀਂ ਮਹਿੰਦੀ ਵਾਲੇ ਦਿਨ ਲਈ ਗੱਲ ਕਰ ਰਹੀ ਆ ਮੈਂ ਹਾਂਜੀ ਉਸ ਤੋਂ ਬਾਅਦ ਹਾਂਜੀ ਉਹ ਚੱਲਦਾ ਆ ਯੈਲੋ ਚੱਲਦਾ ਹਾਂਜੀ ਫੁਲਕਾਰੀ ਲੈ ਲਈ ਲੈ ਸਕਦੇ ਹੋ ਤੁਸੀਂ ਨਾਲ ਇੱਦਾਂ ਤੁਸੀਂ ਹਾਂਜੀ ਅਲੱਗ ਅਲੱਗ ਡੇ 'ਤੇ ਬਰਾਤ ਵਾਲੇ ਦਿਨ ਦੇਖੋ ਮੈਂ ਦੱਸਿਆ ਤੁਹਾਨੂੰ ਸਰਕੂਲਰ ਪਲਾਜ਼ੋ ਚੱਲਦੇ ਹੈ ਅੱਜ ਕੱਲ੍ਹ ਔਰ ਸ਼ੋਰਟ ਕੁੜਤੀ ਜਾਂ ਲੌਂਗ ਕੁੜਤੀ ਓ ਤੁਹਾਡੇ ਉੱਪਰ ਡਿਪੈਂਡ ਹੈ ਤੁਸੀਂ ਤੁਹਾਨੂੰ ਕਿੱਦਾਂ ਦਾ ਪਸੰਦ ਹੈ ਹਾਂਜੀ ਔਰ ਕਦ ਵਿਆਹ ਕਦੋਂ ਹੈ ਅੱਛਾ ਜੀ ਫਿਰ ਤੁਸੀਂ ਟਾਈਮ ਤੋਂ ਨਾ ਆਪਣੇ ਸੂਟ ਦੇ ਦਿਓ ਕਿ ਮੈਂ ਟਾਈਮ 'ਤੇ ਤਿਆਰ ਕਰ ਸਕਾਂ ਰੈਡੀ ਕਰ ਸਕਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਪਹਿਲੇ ਦਿੱਤੇ ਓ ਆਪਾਂ ਟ੍ਰਾਇ ਕਰਵਾ ਸਕਦੇ ਹਾਂ ਕੋਈ ਵੀ ਮਿਸਟੇਕ ਹੋਈ ਤਾਂ ਆਪਾਂ ਠੀਕ ਕਰਵਾ ਸਕਦੇ ਹਾਂ ਮੈਡਮ ਹਾਂਜੀ ਇਹ ਸੁੰਦਰ ਨਗਰ 'ਚ ਹੈਗੀ ਹੈ ਮੈਮ ਐੱਸ ਬੀ ਆਈ ਬੈਂਕ ਦੇ ਨਾਲ ਹੀ ਆ ਹਾਂਜੀ ਹਾਂਜੀ ਹਾਂਜੀ ਮੈਮ ਸਾਡੇ ਕੋਲ ਵੀ ਪਏ ਹੈ ਕੱਪੜੇ ਜਿਸ ਤਰ੍ਹਾਂ ਹਰ ਵਰਾਇਟੀ ਦਾ ਕਲਰ ਵਾਈਸ ਜਿੱਦਾਂ ਤੁਸੀਂ ਤੁਹਾਨੂੰ ਜੋ ਵੀ ਪਸੰਦ ਹੋਏ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਬੁਟੀਕ ਹੈ ਨਾ ਆਪਣਾ ਹਾਂਜੀ ਹਾਂਜੀ ਹਾਂਜੀ ਸਭ ਕੁਛ ਹੈਗਾ ਆਪਣੇ ਕੋਲ ਥੈਂਕਿਊ ਜੀ ਥੈਂਕਿਊ ਓਕੇ